ਭਾਰਤ ਵਿੱਚ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ ਹੈ ਜਿਸ ਦੇ ਕਾਰਨ ਸਰਕਾਰ ਨੇ ਇਸ ਚੁਣੌਤੀ ਨੂੰ ਪੂਰਾ ਕਰਨ ਲਈ ਥਾਂ ਥਾਂ 'ਤੇ ਮੋਲ ਅਤੇ ਮੋਲ ਖੋਲ੍ਹੇ ਹਨ ਜਿਸ ਕਾਰਨ ਬੇਰੁਜ਼ਗਾਰੀ 'ਚ ਕਾਫੀ ਹੱਦ ਤੱਕ ਤਰੱਕੀ ਕੀਤੀ ਹੈ ਲੋਕੀ ਮਤਲਬ ਬੱਚਿਆਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਬਾਹਰੋਂ ਵੀ ਕੰਪਨੀਆਂ ਆ ਲਿਆਉਣ ਕੇ ਖੋਲ੍ਹੀਆਂ ਕੰਪਨੀਆਂ ਕੰਪਨੀਆਂ ਨੇ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ ਜਿਸ ਕਾਰਨ ਬੱਚਿਆਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਲੋਕੀ ਆਪਣੇ ਛੋਟੇ ਮੋਟੇ ਧੰਦੇ ਕਰਕੇ ਵੀ ਆਪਣਾ ਸਵੈ ਰੁਜ਼ਗਾਰ ਨੂੰ ਗੌਰਮੈਂਟ ਨੇ ਬਹੁਤ ਵਧੀਆ ਪ੍ਰੋਤਸਾਹਨ ਕੀਤਾ ਹੈ ਉਨ੍ਹਾਂ ਨੂੰ ਸਬਸਿਡੀ ਵਾਲਾ ਲੋਨ ਵਗੈਰਾ ਦੇ ਕੇ ਆਪਣੇ ਧੰਦੇ ਸ਼ੁਰੂ ਕਰਾਏ ਹਨ ਅਤੇ ਇੱਕ ਦੂਜੀ ਚੁਣੌਤੀ ਹੈਗੀ ਹੈ ਨਸ਼ਿਆਂ ਦੀ ਜਿਸ ਕਾਰਨ ਸਾਡਾ ਸਮਾਜ ਕਾਫੀ ਜਿਹੜਾ ਨੌਜਵਾਨ ਵਰਗ ਹੈ ਨਸ਼ਿਆਂ ਵੱਲ ਜਾ ਰਿਹਾ ਹੈ ਉਸਨੂੰ ਠੱਲ ਪਾਉਣ ਲਈ ਗੌਰਮੈਂਟ ਨੇ ਥਾਂ ਥਾਂ 'ਤੇ ਨਸ਼ੇ ਛਡਾਓ ਕੇਂਦਰ ਖੋਲ੍ਹੇ ਹਨ ਜਿੱਥੇ ਕਿ ਉਹਨਾਂ ਨੂੰ ਫਰੀ 'ਚ ਹੀ ਡੋਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਯੋਗਾ ਵਗੈਰਾ ਕਰਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇੱਕ ਆਪਣਾ ਹੋ ਗਿਆ ਚੁਣੌਤੀ ਟਰੈਫਿਕ ਦੀ ਹੈਗੀ ਹੈ ਸੜਕਾਂ 'ਤੇ ਵੀ ਬਹੁਤ ਆਵਾਜਾਈ ਦੇ ਸਾਧਨ ਹੋ ਗਏ ਹਨ ਜਿਸ ਕਾਰਨ ਥਾਂ ਥਾਂ 'ਤੇ ਟਰੈਫਿਕ ਹੈ ਅਤੇ ਉਹਦੇ ਲਈ ਵੀ ਟਰੈਫਿਕ ਪੁਲਿਸ ਦਾ ਇੰਤਜ਼ਾਮ ਕੀਤਾ ਹੋਇਆ ਗੌਰਮੈਂਟ ਨੇ ਹੋਰ ਵੀ ਬਹੁਤ ਲਾਈਟਾਂ ਲਗਾਈਆਂ ਹਨ ਥਾਂ ਥਾਂ ਜਿਹਦੇ ਕਾਰਨ ਉਹਦੀ ਟਰੈਫਿਕ 'ਚ ਐਕਸੀਡੈਂਟਾਂ 'ਚ ਠੱਲ੍ਹ ਪਏਗੀ